ਸਾਡੇ ਪਿੰਡ ਵਿੱਚ ਪਾਣੀ ਦੀ ਘਾਟ ਜਾਂ ਸੋਕਾ ਨਹੀਂ ਪਿਆ ਕਦੇ ਪਰ ਜੇ ਇਹ ਸਾਡੇ ਪਿੰਡ ਵਿੱਚ ਆਉਂਦਾ ਹੈ ਤਾਂ ਇਸ ਦੇ ਕਾਫ਼ੀ ਨੈਗੀਟਿਵ ਕੋਨਸੀਕਿਉਂਨੈਂਸਿਜ਼ ਸਾਨੂੰ ਦੇਖਣ ਨੂੰ ਮਿਲ ਸਕਦੇ ਹਨ ਜਿੱਦਾਂ ਕਿ ਕਿਸਾਨ ਜ਼ਿਆਦਾਤਰ ਸਾਰੇ ਕਿਸਾਨ ਪਾਣੀ 'ਤੇ ਡੀਪੈਂਡ ਕਰਦੇ ਹੈ ਆਪਣੀਆਂ ਫ਼ਸਲਾਂ ਨੂੰ ਪਾਣੀ ਦੇਣ ਲਈ ਜਿਹਦੇ ਕਰਕੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਚਾਹੀਦਾ ਹੁੰਦਾ ਹੈ ਫਸਲਾਂ ਨੂੰ ਗ੍ਰੋਅ ਕਰਨ ਲਈ ਅਤੇ ਜੇ ਪਾਣੀ ਨਾ ਹੋਵੇ ਤਾਂ ਉਹਨਾਂ ਦੀਆਂ ਫਸਲਾਂ ਮਰ ਸਕਦੀਆਂ ਹਨ ਅਤੇ ਫਸਲਾਂ ਤੋਂ ਹੀ ਉਹ ਆਪਣਾ ਇਹ ਕਾਰੋਬਾਰ ਚਲਾਉਂਦੇ ਹਨ ਘਰ ਦਾ ਖ਼ਰਚਾ ਚਲਾਉਂਦੇ ਹਨ ਅਤੇ ਉਹ ਉਹਨਾਂ ਦਾ ਘੱਟ ਸਕਦਾ ਹੈ ਅਤੇ ਅਗਰ ਜੇ ਪਾਣੀ ਦੀ ਘਾਟ ਹੋਵੇ ਤਾਂ ਸਾਡੀ ਡੇਲੀ ਲਾਈਫ਼ ਵਿੱਚ ਜਿੱਦਾਂ ਆਪਾਂ ਪਾਣੀ ਯੂਜ਼ ਕਰਦੇ ਹਾਂ ਸਾਫ਼ ਸਫਾਈ ਲਈ ਇਹ ਕੱਪੜੇ ਧੋਣ ਲਈ ਹੋਰ ਨਹਾਉਣ ਲਈ ਅਤੇ ਜੇ ਪਾਣੀ ਨਾ ਹੋਵੇ ਤਾਂ ਪਿੰਡਾਂ ਦੇ ਲੋਕਾਂ ਨੂੰ ਇਸ ਦੀ ਘਾਟ ਕਰਕੇ ਗੰਦਗੀ ਵੀ ਹੋ ਸਕਦੀ ਹੈ ਅਤੇ ਸਾਫ਼ ਸਫਾਈ ਕ ਦੀ ਘਾਟ ਹੋ ਸਕਦੀ ਹੈ ਅਤੇ ਪਾਣੀ ਘੱਟ ਪਿੰਡਾਂ ਵਿੱਚ ਪਾਣੀ ਦੀ ਘਾਟ ਹੋਣ ਕਰਕੇ ਲੋਕ ਹੋਰ ਜਗ੍ਹਾ ਵਿੱਚ ਜਾ ਸਕਦੇ ਹਨ ਪਿੰਡ ਛੱਡ ਕੇ ਜਿਸ ਨਾਲ਼ ਪਿੰਡ ਦੀ ਆਬਾਦੀ ਵੀ ਘੱਟ ਸਕਦੀ ਹੈ ਅਤੇ ਪਿੰਡ ਪਾ ਪਾਣੀ ਦੀ ਘਾਟ ਕਰਕੇ ਜੋ ਕਿਸਾਨ ਪਸ਼ੂਆਂ ਨੂੰ ਪਾਲਦੇ ਹਨ ਉਹਨਾਂ ਨੂੰ ਪੀਣ ਲਈ ਪਾ ਪਾਣੀ ਨਹੀਂ ਮਿਲੇਗਾ ਪਾਣੀ ਨਹੀਂ ਮਿਲੇਗਾ ਤਾਂ ਉਹ ਜ਼ਿਆਦਾ ਆਪਣੀ ਡੇਲੀ ਲਾਈਫ 'ਚ ਜੀਅ ਨਹੀਂ ਸਕਦੇ ਅਤੇ ਦੁੱਧ ਨਹੀਂ ਦੇਣਗੇ ਅਤੇ ਕਿਸਾਨਾਂ ਦਾ ਕਾਰੋਬਾਰ ਤਾਂ ਨਹੀਂ ਚੱਲੇਗਾ ਆਮਦਨ ਨਹੀਂ ਮਿਲੇਗੀ ਉਹਨਾਂ ਨੂੰ ਅਤੇ ਉਹਨਾਂ ਦਾ ਵੀ ਡੇਲੀ ਇੰਨਕਮ ਦਾ ਰੀਸੋਰਸ ਜੋ ਹੈ ਉਹ ਵੀ ਘੱਟ ਜਾਵੇਗਾ ਅਤੇ ਜੇਕਰ ਪਾਣੀ ਦੀ ਘਾਟ ਹੋਵੇ ਤਾਂ ਪਿੰਡਾਂ ਦੇ ਲੋਕ ਲੋਕਾਂ ਵਿੱਚ ਲੜਾਈ ਦਾ ਵੀ ਕਾਰਨ ਹੋ ਸਕਦਾ ਹੈ ਕਿਉਂਕਿ ਘੱਟ ਪਾਣੀ ਹੋਵੇਗਾ ਤਾਂ ਸਾਰੇ ਥੋੜ੍ਹੇ ਪਾਣੀ ਲਈ ਲੜਨਗੇ ਅਤੇ ਫਿਰ ਲੜਾਈ ਵਧੇਗੀ